ਇਸ ਸੁਨੇਹੇ ਰਾਹੀਂ ਅਸੀਂ ਟਰਾਂਸਪੋਰਟ ਏਜੰਸੀ ਦੁਆਰਾ ਮੁਹੱਈਆ ਕਰਵਾਈ ਗਈ ਕਾਰ ਸੇਵਾ ਦੀ ਸ਼ਿਕਾਇਤ ਦਰਜ ਕਰਵਾ ਰਹੇ ਹਾਂ ਇਹ ਸੇਵਾ ਅਸੀਂ ਚੰਡੀਗੜ੍ਹ ਤੋਂ ਫਤਿਹਗੜ੍ਹ ਸਾਹਿਬ ਤੱਕ ਜਿਹੜਾ ਹੈ ਉਹ ਬੇਨਤੀ ਕੀਤੀ ਸੀ ਪ੍ਰੰਤੂ ਜੋ ਡਰਾਈਵਰ ਹੈ ਚਾਲਕ ਹੈ ਕਾਰ ਦਾ ਉਹਨੇ ਉਸਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ ਅਤੇ ਦੂਸਰੀ ਗੱਲ ਜਿਹੜਾ ਕਾਰ ਦੀਆਂ ਸੀਟਾਂ ਗੰਦੀਆਂ ਸਨ ਅਤੇ ਕਾਰ ਦੀ ਸਾਫ਼ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ ਤਾਂ ਸਾਡੀ ਬੇਨਤੀ ਹੈ ਔਰ ਅਸੀਂ ਅਸੀਂ ਇਸ ਸੁਨੇਹੇ ਰਾਹੀਂ ਆਪਣੀ ਨਿਰਾਸ਼ਤਾ ਜਿਹੜਾ ਹੈ ਵਿਅਕਤ ਕਰਦੇ ਹਾਂ ਅਤੇ ਅੱਗੇ ਤੋਂ ਇਸ ਤਰ੍ਹਾਂ ਨਾ ਹੋਵੇ ਇਹਦੇ ਲਈ ਤਾਕੀਦ ਵੀ ਕਰਦੇ ਹਾਂ